ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਮਲੋਟ ਇੱਥੋਂ ਲਾਈਬਰੇਰੀ 'ਚ ਬੋਲ ਰਹੇ ਹੋ ਮੈਮ ਲਾਈਬਰੇਰੀ ਦੇ ਵਿੱਚ ਮੈਂ ਬੁੱਕ ਵਗੈਰਾ ਦਾ ਪੁੱਛਣਾ ਸੀਗਾ ਮੈਮ ਪਹਿਲਾਂ ਇੱਥੇ ਸੀਟੈਟ ਅਤੇ ਪੀਐਸਟੈਟ ਦੀਆਂ ਕਿਤਾਬਾਂ ਹੋਣਗੀਆਂ ਓ ਠੀਕ ਹੈ ਜੀ ਅਤੇ ਮੈਮ ਨੋਟਸ ਵਗੈਰਾ ਵੀ ਹੋਣਗੇ ਤੁਹਾਡੇ ਕੋਲ ਠੀਕ ਹੈ ਜੀ ਅਤੇ ਮੈਮ ਬੁੱਕ ਬੁੱਕਸ ਲੈਣ ਲਈ ਵੀ ਕੀ ਤੁਹਾਡਾ ਕੋਈ ਪ੍ਰੋਸੈਸ ਵਗੈਰਾ ਤੁਸੀਂ ਮੈਨੂੰ ਦੱਸ ਸਕਦੇ ਹੋ ਹਾਂਜੀ ਹਾਂਜੀ ਮੈਮ ਬੁੱਕ ਇਸ਼ੂ ਹੀ ਕਰਵਾਉਣੀਆਂ ਨੇ ਮੈਮ ਠੀਕ ਹੈ ਮੈਮ ਅਤੇ ਬੁੱਕ ਹਾਂਜੀ ਅਤੇ ਮੈਮ ਜੇ ਕੋਈ ਬੁੱਕ ਵੀ ਅਸੀਂ ਇਸ਼ੂ ਕਰਵਾਉਣੀ ਹੋਵੇ ਅਤੇ ਜਿਵੇਂ ਵੀ ਵੀ ਇਸ਼ੂ ਕਰਵਾਉਣਾ ਅਸੀਂ ਕੋਈ ਕਾਰਡ ਵਗੈਰਾ ਤੁਹਾਡਾ ਹਾਂਜੀ ਮੈਮ ਓਕੇ ਮੈਮ ਅਤੇ ਮੈਮ ਕਾਰਡ ਦੇ ਉੱਤੇ ਮੈਂ ਪੰਦਰ੍ਹਾਂ ਦਿਨਾਂ ਤੋਂ ਵੱਧ ਵੀ ਬੁੱਕ ਰੱਖ ਸਕਦੀ ਹਾਂ ਓਕੇ ਵੀ ਜਿਵੇਂ ਪੱਖੇ ਵਗੈਰਾ ਜਾਂ ਏ ਸੀ ਵਗੈਰਾ ਲੱਗੇ ਹੋਏ ਨੇ ਵੀ ਜੇ ਕੋਈ ਪ੍ਰੋਬਲਮ ਨਾ ਆਵੇ ਗਰਮੀਆਂ ਦੇ ਵਿੱਚ ਓਕੇ ਮੈਮ ਓਕੇ ਠੀਕ ਹੈ ਜੀ ਮੈਮ ਅਤੇ ਹੋਰ ਵੀ ਕਈ ਬੱਚੇ ਆਉਂਦੇ ਹੋਣਗੇ ਸੋ ਵੀ ਪੀਐਸਟੈਟ ਨਾਲ ਰਿਲੇਟਿਡ ਬੱਚੇ ਓਕੇ ਮੈਮ ਮੈਮ ਇੱਥੇ ਕੋਈ ਬੁੱਕ ਲੱਭਣ ਦਾ ਕੋਈ ਇਸ਼ੂ ਤਾਂ ਨਹੀਂ ਵੀ ਸਾਨੂੰ ਅਲੱਗ ਅਲੱਗ ਕੋਰਨਰ ਮਿਲ ਜਾਣਗੇ ਵੀ ਜਿਵੇਂ ਪੀਐਸਟੈਟ ਦੀਆਂ ਬੁੱਕਸ ਅਲੱਗ ਕੋਰਨਰ ਹਨ ਸੀਟੈਟ ਦੀਆਂ ਅਲੱਗ ਕੋਰਨਰ ਹਾਂਜੀ ਓਕੇ ਮੈਮ ਮੀਨਸ ਕਿ ਬੁੱਕਸ ਲੱਭਣ 'ਚ ਕੋਈ ਦਿੱਕਤ ਨਹੀਂ ਆਏਗੀ ਹਰੇਕ ਬੁੱਕਸ ਦੀ ਜਿਹੜੀ ਹੈਗੀ ਆ ਅਲੱਗ ਅਲੱਗ ਲੱਗੀ ਹੁੰਦੀ ਹੈ ਅਤੇ ਮੈਮ ਬੁੱਕਸ ਵੀ ਜਿਵੇਂ ਮਤਲਬ ਰਾਈਟਰਸ ਦੀਆਂ ਹੁੰਦੀਆਂ ਨੇ ਉਹ ਵੀ ਕੋਈ ਸਿਸਟਮ ਹੈ ਵੀ ਅਲੱਗ ਇੱਕ ਰਾਈਟਰਸ ਦੀਆਂ ਤਾਂ ਨਹੀਂ ਹੋਣਗੀਆਂ ਅਲੱਗ ਅਲੱਗ ਰਾਈਟਰਸ ਦੀਆਂ ਹੋਣਗੀਆਂ ਠੀਕ ਹੈ ਜੀ ਓ ਓਕੇ ਮੈਮ ਓ ਥੈਂਕ ਯੂ ਮੈਮ ਓਕੇ ਮੈਮ ਠੀਕ ਹੈ ਜੀ ਥੈਂਕ ਯੂ ਮੈਮ ਥੈਂਕ